ਹਾਂ ਮੈਂ ਮੱਧ ਪੀੜ੍ਹੀ ਦਾ ਹਿੱਸਾ ਹਾਂ ਜੋ ਕਿ ਪੁਰਾਣੀ ਪੀੜ੍ਹੀ ਅਤੇ ਨੌਜਵਾਨ ਪੀੜ੍ਹੀ ਵਿਚਕਾਰ ਸੰਤੁਲਨ ਦਾ ਪ੍ਰਵਧਨ ਅਤੇ ਕੋਸ਼ਿਸ਼ ਕਰਦੀ ਹੈ ਅਤੇ ਮੈਂ ਦੱਸਦੀ ਹਾਂ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈ ਜਿਵੇਂ ਕਿ ਸਾਨੂੰ ਭੁੱਲਣਾ ਨਹੀਂ ਚਾਹੀਦਾ ਸੰਸਕਾਰ ਬਾਰੇ ਆਪਣੇ ਆਪਣੇ ਰੀਤੀ ਰਿਵਾਜ਼ ਪੂਰੇ ਕਰਨੇ ਚਾਹੀਦੇ ਹੈ ਮੈਂ ਚਾਹੁੰਦੀ ਹਾਂ ਜੋ ਪੁਰਾਣੀ ਪੀਰ ਪੀੜ੍ਹੀ ਹੈ ਉਹ ਨੌਜਵਾਨ ਪੀੜ੍ਹੀ ਨੂੰ ਸਮਝੇ ਅਤੇ ਉਹਨਾਂ ਨੂੰ ਜਾਣੂ ਕਰਵਾਏ ਸੋਚ ਸਮਝ ਕੇ ਕੋਈ ਵੀ ਫੈਸਲਾ ਲਵੇ ਤਾਂ ਕਿ ਇੱਕ ਦੂਜੇ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਅਤੇ ਉਹਨਾਂ ਦੀ ਸੋਚ ਵਿੱਚ ਬਹੁਤ ਜ਼ਿਆਦਾ ਹੀ ਡਿਫਰੈਂਸ ਹੈ ਉਹਨਾਂ ਦਾ ਰਹਿਣ ਸਹਿਣ ਖਾਣਾ ਪੀਣਾ ਜਾਣ ਜਾਣਾ ਹੈ ਇੱਕ ਦੂਜੇ ਥਾਂ ਉੱਠਣਾ ਬੈਠਣਾ ਬਹੁਤ ਜ਼ਿਆਦਾ ਅਲੱਗ ਹੈ ਇਸ ਲਈ ਮੈਂ ਚਾਹੁੰਦੀ ਹਾਂ ਕਿ ਜੋ ਪੁਰਾਣੀ ਪੀੜ੍ਹੀ ਹੈ ਪੁਰਾਣੀ ਪੀੜ੍ਹੀ ਹੈ ਉਹ ਨੌਜਵਾਨ ਪੀੜ੍ਹੀ ਤੋਂ ਬਹੁਤ ਜ਼ਿਆਦਾ ਅਲੱਗ ਹੈ ਮੈਂ ਚਾਹੁੰਦੀ ਹਾਂ ਇਹਨਾਂ ਇਸ ਨੂੰ ਸੰਭਾਲਣ ਲਈ ਨੌਜਵਾਨ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਨੂੰ ਸੰਭਾਲੇ ਉਹ ਇੱਕ ਦੂਜੇ ਨੂੰ ਪਹਿਲਾਂ ਤਾਂ ਸਮਝਣ ਅਤੇ ਫਿਰ ਮੈਂ ਚਾਹੁੰਦੀ ਹਾਂ ਜੋ ਮੇਰੇ ਬੱਚੇ ਹਨ ਉਹ ਵੀ ਪੁਰਾਣੇ ਪੀੜ੍ਹੀ ਵਾਲੇ ਰੀਤੀ ਰਿਵਾਜ਼ ਨਾ ਭੁੱਲਣ ਅਤੇ ਮੈਂ ਚਾਹੁੰਦੀ ਹਾਂ ਉਹਨਾਂ ਨੂੰ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ ਖਾਣ ਪੀਣ ਬਾਰੇ ਰਹਿਣ ਸਹਿਣ ਬਾਰੇ ਉੱਠਣ ਬੈਠਣ ਦਾ ਤਰੀਕਾ ਬੋਲਣ ਦਾ ਤਰੀਕਾ ਸਭ ਕੁਛ ਮੰਨਣੀ ਚਾਹੀਦੀ ਹੈ ਕਿਉਂਕਿ ਵੱਡਿਆਂ ਦੀ ਗੱਲ ਮੰਨਣੀ ਚਾਹੀਦੀ ਹੈ ਅਤੇ ਉਹਨਾਂ ਦੇ ਸੰਸਕਾਰ ਕਦੇ ਵੀ ਬੁਰੇ ਨਹੀਂ ਹੁੰਦੇ ਹੈ ਅਤੇ ਮੈਂ ਚਾਹੁੰਦੀ ਹਾਂ ਦੋਨੋਂ ਇੱਕ ਦੂਜੇ ਨੂੰ ਸਮਝਣ ਅਤੇ ਨੌਜਵਾਨ ਪੀੜ੍ਹੀ ਇੱਕ ਨੌਜਵਾਨ ਪੀੜ੍ਹੀ ਇਸਨੂੰ ਸੰਭਾਲੇ ਅਤੇ ਪੁਰਾਣੀ ਪੀੜ੍ਹੀ ਦੇ ਰੀਤੀ ਰਿਵਾਜ਼ ਨੂੰ ਨਾ ਭੁੱਲੇ ਇਸ ਲਈ ਮੈਂ ਚਾਹੁੰਦੀ ਹਾਂ ਕਿ ਪੁਰਾਣੀ ਪੀੜ੍ਹੀ ਅਤੇ ਨੌਜਵਾਨ ਪੂ ਪੀੜ੍ਹੀ ਇੱਕ ਦੂਜੇ ਨੂੰ ਸਮਝ ਕੇ ਇੱਕ ਦੂਜੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰੇ